ਸਾਡੇ ਮੌਤ ਦਰ ਦਾ ਪਿੰਡ ਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਇੱਥੇ ਇੱਕ ਸਰਕਾਰੀ ਹਸਪਤਾਲ ਹੈ ਸਭ ਹਸਪਤਾਲ ਆ ਉਹ ਬਾਕੀ ਬੱਚਿਆਂ ਨੂੰ ਦੋ ਮੁੱਖ ਕਾਰਨ ਇੱਕ ਮਲੇਰੀਆ ਅਤੇ ਇੱਕ ਡੇਂਗੂ ਇਹਨਾਂ ਦੇ ਵਾਸਤੇ ਨਾ ਤਾ ਹਸਪਤਾਲ ਵਾਲਾ ਕੋਈ ਅਫਸਰ ਸੀ ਐਮ ਓ ਜਾਂ ਹੋਰ ਡਾਕਟਰ ਕੋਈ ਟੀਕੇ ਪ੍ਰਲੰਧ ਕਰਾਉਂਦਾ ਅਤੇ ਨਾ ਹੀ ਜਿਹੜੀਆਂ ਆਂਗਣਵਾੜੀ ਲੜਕੀਆਂ ਰੱਖੀਆਂ ਹਨ ਉਹਨਾਂ ਕੋਲ ਵਿਚਾਰੀਆਂ ਕੋਲ ਕੁਝ ਹੈ ਜੇ ਹੋ ਸਕੇ ਤਾਂ ਸਰਕਾਰ ਇਹਨਾਂ ਵੱਲ ਧਿਆਨ ਦੇਣ ਤਾਂ ਮੌਤ ਦਰ ਘੱਟ ਵੀ ਸਕਦੀ ਹੈ ਪਰ ਹਜੇ ਬੱਚਿਆਂ ਦੀ ਮੌਤ ਦਰ ਤਾਂ ਮੈਂ ਵੇਖੀ ਹੋਈ ਬਹੁਤ ਥੋੜ੍ਹੀ ਹੈ ਪਰ ਸਾਡੇ ਹਰ ਹਫ਼ਤੇ ਦੇ ਵਿੱਚ ਇੱਕ ਸੱਤਰ ਅੱਸੀ ਸਾਲ ਪੰਜਾਹ ਪੰਜਾਹ ਸੱਠ ਸਾਲ ਦਾ ਬੰਦਾ ਮਰ ਜਾਂਦਾ ਇਹ ਪਤਾ ਨਹੀਂ ਕੀ ਗੱਲ ਹੈ ਤਿੰਨ ਮਹੀਨੇ ਹੋ ਗਏ ਹਰ ਹਫ਼ਤੇ ਇੱਕ ਮੌਤ ਹੋ ਜਾਂਦੀ ਹੈ ਵੱਡੇ ਬੰਦੇ ਦੀ ਬੱਚਿਆਂ ਦੀ ਤਾਂ ਹਜੇ ਨਹੀਂ ਹੋਈ